ਮੈਂ ਇੱਕ ਪਾਵਰ ਬੈਂਕ ਖਰੀਦਿਆ ਸੀਗਾ ਜਿਹੜਾ ਕਿ ਚੰਡੀਗੜ੍ਹ ਮਾਰਕੀਟ ਦੇ ਵਿੱਚੋਂ ਲਿਆ ਸੀਗਾ ਉਹਦੇ ਉੱਪਰ ਕੋਈ ਸਟਾਰ ਨਾਮ ਕਰਕੇ ਕੁਛ ਲਿਖਿਆ ਹੋਇਆ ਹੈ ਅਤੇ ਮੈਂ ਸੋਚਿਆ ਸੀਗਾ ਮੇਰੇ ਕੋਲ ਆਈਫੋਨ ਸੀਗਾ ਵੀ ਆਪਾਂ ਨੇ ਕਿਤੇ ਬਾਹਰ ਅੰਦਰ ਜਾਣਾ ਹੁੰਦਾ ਮੈਂ ਡਿਊਟੀ ਵੀ ਕਰਦਾ ਹਾਂ ਕਿਤੇ ਲੰਬੇ ਟੂਰ 'ਤੇ ਵੀ ਜਾਣਾ ਪੈ ਜਾਂਦਾ ਏ ਕਿਤੇ ਕੰਪਨੀ ਭੇਜ ਦਿੰਦੀ ਏ ਅਤੇ ਮੈਂ ਸੋਚਿਆ ਸੀਗਾ ਵੀ ਚਲੋ ਇੱਕ ਪਾਵਰ ਬੈਂਕ ਲੈ ਲਿਆ ਜਾਵੇ ਅਤੇ ਜਿਹੜਾ ਮੈਂ ਇਹ ਪਾਵਰ ਬੈਂਕ ਚੰਡੀਗੜ੍ਹ ਮਾਰਕੀਟ 'ਚੋਂ ਲਿਆ ਸੀਗਾ ਇਹਦੀ ਕੁਆਲਿਟੀ ਇੰਨੀ ਚੰਗੀ ਨਹੀਂ ਨਿਕਲੀ ਸ਼ੁਰੂ ਸ਼ੁਰੂ ਦੇ ਵਿੱਚ ਤਾਂ ਇਸਨੇ ਮੈਨੂੰ ਲੱਗਿਆ ਵੀ ਬੜਾ ਬਹੁਤ ਵਧੀਆ ਚੱਲ ਰਿਹਾ ਮੇਰਾ ਫੋਨ ਬੜਾ ਫਟਾਫਟ ਚਾਰਜ ਕਰ ਦਿਆ ਕਰੇ ਪਰ ਹੌਲੀ ਹੌਲੀ ਮੈਂ ਤਾਂ ਜਦ ਦੇਖਿਆ ਵੀ ਇਹ ਤਾਂ ਮੇਰੇ ਫੋਨ ਨੂੰ ਵੀ ਖਰਾਬ ਕਰ ਰਿਹਾ ਅਤੇ ਮੇਰੇ ਫੋਨ ਦੇ ਵਿੱਚ ਵੀ ਖਰਾਬੀ ਆ ਗਈ ਅਤੇ ਮੈਂ ਤਾਂ ਇਹੀ ਕਹੂੰਗਾ ਕਿ ਬਈ ਕੋਈ ਵੀ ਪ੍ਰੋਡਕਟ ਆ ਜੇ ਖਰੀਦਣਾ ਹੋਵੇ ਅਤੇ ਕਿਸੇ ਚੰਗੀ ਕੰਪਨੀ ਦਾ ਹੀ ਲਿਆ ਜਾਵੇ ਮੈਂ ਤਾਂ ਹੋਰਾਂ ਨੂੰ ਵੀ ਇਹੀ ਸਲਾਹ ਦਊਂਗਾ ਵੀ ਇਹੋ ਜਿਹੀ ਕੋਈ ਚੀਜ਼ ਜਦ ਲੈਣੀ ਹੋਵੇ ਨਾ ਅਤੇ ਮਤਲਬ ਕਿ ਬੰਦਾ ਦੋ ਜਗ੍ਹਾ ਪੁੱਛੇ ਤਾਂ ਕੁਆਲਿਟੀ ਚੰਗੀ ਹੋਵੇ ਤਾਂ ਹੀ ਬੰਦੇ ਨੂੰ ਪੈਸੇ ਲਾਉਣ ਦਾ ਫਾਇਦਾ ਹੈ ਇੱਦਾਂ ਤਾਂ ਆਪਣੀ ਚੀਜ਼ ਮੈਂ ਤਾਂ ਨੁਕਸਾਨ ਹੀ ਕਰ ਲਿਆ ਮੈਂ ਤਾਂ ਹੋਰਾਂ ਨੂੰ ਇਹੀ ਸਲਾਹ ਦਊਂਗਾ ਭਈ ਕਿ ਬਈ ਆਪਣਾ ਚੀਜ਼ ਕੋਈ ਵੀ ਹੈ ਚੰਗੀ ਦੇਖ ਪਰਖ ਕੇ ਲਓ ਨਾਲੇ ਕੰਪਨੀ ਦੀ ਲਓ ਸਭ ਤੋਂ ਬੜੀ ਗੱਲ ਇਹ ਹੈ ਨਹੀ ਤਾਂ ਆਪਣੀ ਦੂਜੀ ਚੀਜ਼ ਵੀ ਖਰਾਬ ਕਰਨ ਵਾਲੀ ਗੱਲ ਆ ਸਾਥੀਓ ਆਪਣੀ ਤਾਂ ਇਹੀ ਗੱਲ ਆ ਵੀ ਕੋਈ ਵੀ ਚੀਜ਼ ਆ ਵਧੀਆ ਲਓ ਕੰਪਨੀ ਦੀ ਦੇਖ ਕੇ ਤਾਂ ਕਿ ਆਪਣੀ ਚੀਜ਼ ਦਾ ਨੁਕਸਾਨ ਨਾ ਹੋਵੇ